ਹੈਲੋ ਹਾਂਜੀ ਤੁਸੀਂ ਠੀਕ ਹੈ ਜੀ ਹਾਂਜੀ ਹਾਂਜੀ ਮੇਲੇ ਬਹੁਤ ਲੱਗਦੇ ਹੈ ਬਿਲਕੁਲ ਆਪਣੇ ਬਹੁਤ ਸਾਰੇ ਮੇਲੇ ਲੱਗਦੇ ਹੈ ਅਲੱਗ ਅਲੱਗ ਤਿਉਹਾਰਾਂ 'ਤੇ ਜਿਵੇਂ ਆਏਂ ਕਹਿ ਲਉ ਕਿ ਵੀ ਆਪਣੇ ਇੱਥੇ ਗੁਰਦੁਆਰਾ ਹੈਗਾ ਗੁੱਦਰ ਸ਼ਾਹ ਦਾ ਮੇਲਾ ਲੱਗਦਾ ਇੱਥੇ ਜਿਵੇਂ ਅਗਰ ਕਿਸੇ ਦੀ ਮੈਰਿਜ ਹੁੰਦੀ ਹੈ ਵੀ ਤਾਂ ਉਹ ਕੀ ਹੈ ਭੇਲੀ ਚੜ੍ਹਾ ਕੇ ਜਾਂਦੇ ਹੈ ਗੁੜ ਚੜ੍ਹਾ ਕੇ ਜਾਂਦੇ ਹੈ ਇਹ ਸੰਤਾਂ ਦਾ ਹੈ ਸਾਧੂ ਸੰਤਾਂ ਦਾ ਹੈ ਠੀਕ ਹੈ ਇੱਥੇ ਬਿਲਕੁਲ ਹਰ ਮੰਨਤ ਪੂਰੀ ਹੁੰਦੀ ਹੈ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈਗਾ ਵਧੀਆ ਬਾਹਰੋਂ ਕਲਾਕਾਰ ਆਉਂਦੇ ਨੇ ਬਹੁਤ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਉਰੇ ਮੇਲਾ ਬਹੁਤ ਵੱਡੇ ਪੱਧਰ 'ਤੇ ਲੱਗਦਾ ਹੈ ਜਿਵੇਂ ਆਪਣੇ ਕਲਿਆਣੇ ਵੀ ਲੱਗਦਾ ਹੈਗਾ ਮੇਲਾ ਬੁਢਲਾਡੇ ਕੋਲ ਕਲਿਆਣੇ ਉੱਥੇ ਵੀ ਲੱਗਦਾ ਮੇਲਾ ਬਹੁਤ ਥਾਵਾਂ 'ਤੇ ਲੱਗਦਾ ਹੈ ਆਪਣੇ ਉਰੇ ਮਾਨਸਾ ਜ਼ਿਲ੍ਹਾ 'ਚ ਹਾਂਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਦੂਰ ਤੋਂ ਆਉਂਦੇ ਨੇ ਸੋਚ ਵੀ ਨਹੀਂ ਸਕਦੇ ਬਹੁਤ ਦੂਰੋਂ ਆਉਂਦੇ ਨੇ ਉਰੇ ਆਪਦੀ ਮੰਨਤ ਪੂਰੀ ਕਰਨ ਲਈ ਜਿਨ੍ਹਾਂ ਦੀ ਮੰਨਤ ਪੂਰੀ ਹੋ ਜਾਂਦੀ ਉਹ ਭੇਲੀ ਚੜ੍ਹਾ ਕੇ ਜਾਂਦੇ ਨੇ ਬਹੁਤ ਮਾਨਤ ਹੈਗੀ ਇਸ ਗੁਰਦੁਆਰੇ ਦੀ ਇੱਕ ਇੱਥੇ ਗੁੱਦਰ ਸ਼ਾਹ ਦੇ ਡੇਰੇ ਦੀ ਵੀ ਬਹੁਤ ਮਾਨਤ ਹੈਗੀ ਹੈ ਇੱਥੇ ਆਈ ਵਾਰ ਮਤਲਬ ਐਂ ਕਹਿ ਲਉ ਫਰਬਰੀ ਦੇ ਮਹੀਨੇ 'ਚ ਲੱਗਦਾ ਹੈਗਾ ਫਰਬਰੀ ਮਾਰਚ ਦੇ ਮਹੀਨੇ 'ਚ ਮੇਲਾ ਹਾਂਜੀ ਹਾਂਜੀ ਹਾਂਜੀ ਬਸੰਤ ਪੰਚਮੀ 'ਤੇ ਹੀ ਲੱਗਦਾ ਹੈਗਾ ਹਾਂਜੀ ਹਾਂਜੀ ਬਿਲਕੁਲ ਸਹੀ ਸੁਣਿਆ ਤੁਹ ਨੇ ਬਹੁਤ ਦੂਰੋਂ ਦੂਰੋਂ ਆਉਂਦੇ ਲੋਕ ਉਰੇ ਅਤੇ ਉਰੇ ਉਹਨਾਂ ਦੀਆਂ ਜਿਵੇਂ ਜਿਵੇਂ ਆਪਣੀਆਂ ਮੰਨਤਾਂ ਪੂਰੀਆਂ ਹੋਈ ਜਾਂਦੀਆਂ ਨੇ ਆਪਾਂ ਐਵੇਂ ਅੱਗੇ ਦੀ ਅੱਗੇ ਲੋਕਾਂ ਨੂੰ ਦੱਸਦੇ ਹਾਂ ਹੋਰ ਵੀ ਆਪਣੀ ਸਾਡੀ ਮੰਨਤ ਪੂਰੀ ਹੋਊਗੀ ਠੀਕ ਹੈ ਵੀ ਅਸੀਂ ਇੱਥੇ ਗਏ ਸੀਗੇ ਇੱਥੇ ਮੇਲੇ 'ਚ ਗਏ ਸੀਗੇ ਇੱਥੇ ਮੇਲੇ 'ਚ ਜਾ ਕੇ ਸਾਨੂੰ ਆਹ ਚੀਜ਼ਾਂ ਦੇਖਣ ਨੂੰ ਮਿਲੀਆਂ ਬਹੁਤ ਕਲਾਕਾਰ ਆਉਂਦੇ ਹੈ ਬਹੁਤ ਜ਼ਿਆਦਾ ਇੱਥੇ ਡਰਾਮੇ ਵੀ ਦਿਖਾਏ ਜਾਂਦੇ ਹੈ ਬਹੁਤ ਐਂਏ ਕਹਿ ਲਉ ਕਿ ਵੀ ਸਾਰੇ ਨੈਚੂਰਲ ਹੁੰਦੇ ਆ ਮਤ ਸਾਰੇ ਕੁਦਰਤ ਨਾਲ ਰਿਲੇਟਡ ਹੁੰਦੇ ਹੈ ਆਪਣੇ ਸਾਰੇ ਕਲਾਕਾਰ ਨਾਲ ਰਿਲੇਟਡ ਹੁੰਦੇ ਵੀ ਕਿਹੜੀਆਂ ਚੀਜ਼ਾਂ ਤੋਂ ਆਪਾਂ ਨੂੰ ਦੂਰ ਰਹਿਣਾ ਚਾਹੀਦਾ ਉਨ੍ਹਾਂ ਬਾਰੇ ਵੀ ਇੱਥੇ ਨਾਟਕਾਂ ਰਾਹੀਂ ਦੱਸਿਆ ਜਾਂਦਾ ਹੈਗਾ ਬਹੁਤ ਕੁਛ ਮਤਲਬ ਵਧੀਆ ਸੱਭਿਆਚਾਰਕ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਆਪਾਂ ਨੂੰ ਇੱਥੇ ਹਾਂਜੀ ਹਾਂਜੀ ਬਿਲਕੁਲ ਪੂਰਾ ਲੋਕ ਗੀਤ ਗਾਏ ਜਾਂਦੇ ਨੇ ਇੱਥੇ ਸ਼ਾਮ ਨੂੰ ਠੀਕ ਹੈ ਦਿਨੇ ਸੱਭਿਆਚਾਰਕ ਬਾਰੇ ਆਪਾਂ ਨੂੰ ਜਿਵੇਂ ਬੋਲੀਆਂ ਹੋ ਗਈਆਂ ਉਹ ਪਵਾਉਂਦੇ ਨੇ ਉਹ ਪਾਈਆਂ ਜਾਂਦੀਆਂ ਨੇ ਗੀਆਂ ਠੀਕ ਹੈ ਇੱਦਾਂ ਮਤਲਬ ਹਰ ਇੱਕ ਚੀਜ਼ ਸੱਭਿਆਚਾਰ ਨਾਲ ਰਿਲੇਟਡ ਹੁੰਦੀ ਹੈ ਆਪਣੇ ਉਰੇ ਹਰ ਮੇਲੇ ਹਰ ਤਿਉਹਾਰ 'ਤੇ ਹਾਂਜੀ ਠੀਕ ਹੈ ਜੀ ਓਕੇ ਵੈਲਕਮ